ਦੌੜ ਦੀ ਤਿਆਰੀ ਕਰਨ ਲਈ ਜੋ ਪੋਸ਼ਣ ਅਤੇ ਹਾਈਡਰੇਸ਼ਨ ਹੈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਪੋਸ਼ਣ ਵਿੱਚ ਆਪਣੇ ਪੰਜਾਬ ਵਿੱਚ ਦੁੱਧ ਦਹੀਂ ਲੱਸੀ ਦੀ ਕੋਈ ਕਮੀ ਨਹੀਂ ਹੈ ਤਾਂ ਸਭ ਤੋਂ ਪਹਿਲਾਂ ਦੁੱਧ ਦਹੀਂ ਲੱਸੀ ਤੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਭਰਪੂਰ ਮਾਤਰਾ ਵਿੱਚ ਅਤੇ ਦਾਲ਼ਾਂ ਹੋ ਗਈਆਂ ਫਲ਼ ਫਰੂਟ ਖਾਣੇ ਚਾਹੀਦੇ ਹਨ ਅੰਡੇ ਵਗੈਰਾ ਹੋ ਗਏ ਇਹ ਵੀ ਲੈਣੇ ਚਾਹੀਦੇ ਹਨ ਅਤੇ ਬੋਡੀ ਨੂੰ ਹਾਈਡਰੇਟ ਰੱਖਣ ਲਈ ਪਾਣੀ ਦੀ ਪਾਣੀ ਮਤਲਬ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ ਜਿਸ ਕਾਰਨ ਆਪਣੀ ਮਾਸਪੇਸ਼ੀਆਂ ਵੀ ਮਜ਼ਬੂਤ ਹੁੰਦੀਆਂ ਹਨ ਅਤੇ ਦ ਦੌੜਨ ਵਿੱਚ ਸਹਾਇਤਾ ਮਿਲਦੀ ਹੈ